ਮੈਨੂੰ ਬਚਪਨ ਤੋਂ ਹੀ ਪੰਜਾਬ ਦੇ ਇਤਿਹਾਸ ਬਾਰੇ ਸਿੱਖਣ ਦਾ ਅੰ ਬਹੁਤ ਚਾਅ ਸੀ ਅਤੇ ਇਸ ਨਾਲ ਮੈਨੂੰ ਬਹੁਤ ਹੀ ਆਨੰਦ ਮਿਲਦਾ ਸੀ ਬਚਪਨ ਤੋਂ ਹੀ ਮੈਂ ਆਪਣੀ ਦਾਦੀ ਨਾਨੀਆਂ ਕੋ ਅਤੇ ਦਾਦੇ ਦਾ ਦਾਦਿਆਂ ਕੋ ਇਸ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਪੁੱਛਦੀ ਆਉਂਦੀ ਹਾਂ ਪੁੱਛਦੀ ਰਹਿੰਦੀ ਸੀ ਮੈਨੂੰ ਦਦ ਮੇਰੀ ਦਾਦੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸਾਡੇ ਗੁਰੂਆਂ ਅਤੇ ਦੇਸ਼ ਭਗਤਾਂ ਨੇ ਸਾਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਉੱਤੇ ਖੇਡੇ ਹਨ ਅਤੇ ਸਾਡੇ ਇਤਿਹਾਸ ਅਤੇ ਧਰਮ ਨੂੰ ਬਚਾਇਆ ਹੈ ਅਤੇ ਹੁਣ ਸਾਨੂੰ ਵੀ ਆਪਣੇ ਧਰਮ ਨੂੰ ਬਚਾਉਣਾ ਚਾਹੀਦਾ ਹੈ ਸਾਡੇ ਸਾਡੇ ਗੁਰੂਆਂ ਨੇ ਧਰਮ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹੁਣ ਇਹ ਸਾਡੀ ਵਾਰੀ ਹੈ ਕਿ ਅਸੀਂ ਆਪਣੇ ਪੰਜਾਬੀ ਧਰਮ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਈਏ ਅਤੇ ਇਸ ਦੀ ਰੱਖਿਆ ਕਰੀਏ ਧੰਨਵਾਦ